ਜੀ ਬਿਲਕੁਲ ਮੈਂ ਸਾਈਬਰ ਧੱਕੇਸ਼ਾਹੀ ਬਾਰੇ ਸੁਣਿਆ ਆ ਇਹਦੇ ਵਿੱਚ ਮੈਂ ਅਜ਼ਮਾਇਆ ਵੀ ਹੈ ਕਿ ਇਹਦੇ ਵਿੱਚ ਸਿਰਫ ਵੱਡੇ ਲੋਕਾਂ ਨੂੰ ਜਿਨ੍ਹਾਂ ਦੀ ਅਪਰੋਚ ਆ ਸਿਰਫ ਉਹਨਾਂ ਦੀ ਓ ਹੀ ਸੁਣੀ ਜਾਂਦੀ ਹੈ ਆਮ ਬੰਦੇ ਨੂੰ ਤਾਂ ਐਵੇਂ ਧੱਕੇ ਖਵਾ ਕੇ ਅਤੇ ਬਿਠਾ ਦਿੰਦੇ ਨੇ ਉਹਦੀ ਤਾਂ ਕਦੇ ਸੁਣਵਾਈ ਨਹੀਂ ਹੁੰਦੀ ਅਤੇ ਸੋਸ਼ਲ ਮੀਡੀਆ ਟਰੋਲਿੰਗ ਇਹ ਹੀ ਹੈ ਕਿ ਕਹਿ ਲਓ ਕਿ ਹੁਣ ਜਿਸ ਤਰ੍ਹਾਂ ਕੁਛ ਵੀ ਹੁੰਦਾ ਸਮਾਜ ਦੇ ਵਿੱਚ ਉਹਨੂੰ ਆਪਣੇ ਨਜ਼ਰੀਏ ਨਾਲ ਉਹਨੂੰ ਬਣਾਇਆ ਜਾਂਦਾ ਜਿਸ ਤਰ੍ਹਾਂ ਹੁਣ ਕਹਿ ਲਓ ਕਿ ਕਿਸਾਨ ਅੰਦੋਲਨ ਹੀ ਪੰਜਾਬ 'ਚ ਚੱਲ ਰਿਹਾ ਉਹਨੂੰ ਸੋਸ਼ਲ ਮੀਡੀਆ 'ਤੇ ਆਪਣੇ ਤਰੀਕੇ ਨਾਲ ਦੱਸਿਆ ਜਾਂਦਾ ਅਤੇ ਸੱਚ ਨੂੰ ਸਾਹਮਣੇ ਨਹੀਂ ਆਉਣ ਦਿੱਤਾ ਜਾਂਦਾ ਅਤੇ ਐਵੇਂ ਹਰ ਕਿਸੇ ਦੇ ਖਿਲਾਫ ਦੁਨੀਆਂ ਦੇ ਵਿੱਚ ਮਾਹੌਲ ਖਰਾਬ ਕਰਨ ਵਾਲਾ ਕੰਮ ਕੀਤਾ ਜਾਂਦਾ ਅਤੇ ਇਹ ਲੋਕਾਂ ਨੂੰ ਇੰਨਾ ਪ੍ਰਭਾਵਿਤ ਕਰਦਾ ਹੈ ਕਿ ਲੋਕ ਸੱਚ ਤੋਂ ਕਿੰਨਾ ਹੀ ਦੂਰ ਹੋ ਜਾਂਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਖਿਰ ਸੱਚਾਈ ਹੈ ਕੀ ਸਾਨੂੰ ਇਸ ਮੁੱਦੇ ਨਾਲ ਇੰਝ ਨਜਿੱਠਣਾ ਚਾਹੀਦਾ ਕਿ ਜਦੋਂ ਤੱਕ ਅਸੀਂ ਆਪਣੇ ਅੱਖੀਂ ਨਾ ਦੇਖ ਲਈਏ ਕਦੇ ਵੀ ਮੀਡੀਆ ਸੋਸ਼ਲ ਮੀਡੀਆ 'ਤੇ ਆਉਣ ਵਾਲੀ ਟਰੋਲਿੰਗ ਨੂੰ ਸੱਚ ਨਹੀਂ ਸਮਝਣਾ ਚਾਹੀਦਾ ਅਤੇ ਆਪਣੇ ਵਿਚਾਰ ਐਵੇਂ ਹੀ ਨਹੀਂ ਸਮਾਜ ਬਾਰੇ ਦੇ ਦੇਣੇ ਚਾਹੀਦੇ ਸੋਸ਼ਲ ਮੀਡੀਆ ਦਾ ਵਾਕਿਆ ਹੀ ਸੱਚ ਕਹੋ ਤਾਂ ਬਹੁਤ ਹੀ ਬੁਰਾ ਪ੍ਰਭਾਵ ਪੈ ਰਿਹਾ ਅਸੀਂ ਘੰਟਿਆਂ ਬੱਧੀ ਫੋਨ ਦੇ ਉੱਤੇ ਲੱਗੇ ਰਹਿੰਦੇ ਹਾਂ ਇਸ ਤਰ੍ਹਾਂ ਹੀ ਫਾਲਤੂ ਦੀਆਂ ਰੀਲਾਂ ਦੇਖਦੇ ਰਹਿੰਦੇ ਹਾਂ ਆਪਣਾ ਟਾਈਮ ਵੀ ਬਰਬਾਦ ਕਰਦੇ ਹਾਂ ਆਪਣੀਆਂ ਅੱਖਾਂ ਵੀ ਬਰਬਾਦ ਕਰਦੇ ਹਾਂ ਜਦੋਂ ਕਿ ਇਹਨਾਂ ਚੀਜ਼ਾਂ ਦਾ ਸਾਨੂੰ ਕੋਈ ਫ਼ਾਇਦਾ ਨਹੀਂ ਗਾ ਲੇਕਿਨ ਸਿਰਫ ਅਸੀਂ ਕਹਿ ਲਓ ਕਿ ਇੱਕ ਲੱਤ ਲੱਗ ਚੁੱਕੀ ਆ ਸਾਨੂੰ ਅਤੇ ਮੈਨੂੰ ਤਾਂ ਸੱਚੀ ਇਹਦਾ ਬਹੁਤ ਹੀ ਬੁਰਾ ਅਨੁਭਵ ਹੈਗਾ ਹੈ ਕਿ ਟਾਈਮ ਵੇਸਟ ਅੱਖਾਂ ਵੇਸਟ ਕੰਮ ਵੇਸਟ ਹਰ ਚੀਜ਼ ਦੀ ਵੇਸਟੇਜ ਹੈਗੀ ਹੈ